ਹੈਲੋ ਹੈਲੋ ਹਾਂਜੀ ਗੁਡ ਇਵਨਿੰਗ ਜੀ ਪੰਜਾਬ ਦੀ ਹਿਸਟਰੀ ਬਾਰੇ ਜਾਣਨਾ ਚਾਹੁੰਦੇ ਹੋ ਪੰਜਾਬ ਦੀ ਹਿਸਟਰੀ ਦੇ ਵਿੱਚ ਆਪਣੇ ਖੇਤਰਫਲ

ਅਤੇ ਬਾਕੀ ਆਪਣਾ ਦ ਉਨੱਤੀ ਸਟੇਟਾਂ ਨੇ ਆਪਣਾ ਬਾਈ ਜਿਲ੍ਹੇ ਨੇ ਬਾਈ ਜਿਲ੍ਹੇ ਨੇ ਹੋਰ ਦੱਸੋ ਪੰਜਾਬੀ ਸੱਭਿਆਚਾਰ ਬਹੁਤ ਹੀ ਆਪਣਾ ਇਹ ਬਹੁਤ ਜ਼ਿਆਦਾ ਪ੍ਰਚੱਲਿਤ ਹੈ ਪੰਜਾਬੀ ਸੱਭਿਆਚਾਰ ਪੰਜਾਬੀ ਸਭਿਆਚਾਰ ਦੇ ਵਿੱਚ ਕੁੜੀਆਂ ਗਿੱਧਾ ਅਤੇ ਮੁੰਡੇ ਭੰਗੜਾ ਠੀਕ ਹੈ ਅਤੇ ਬਾਕੀ ਜਿਹੜੇ ਲੋਕ ਗੀਤ ਗਾਏ ਜਾਂਦੇ ਠੀਕ ਹੈ ਲੋਕ ਗੀਤਾਂ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਹੈਗਾ ਕਿ ਕਿੱਦਾਂ ਹੇਕਾਂ ਲੱਗਦੀਆਂ ਨੇ ਔਰ ਕਿੱਦਾਂ ਬੋਲੀਆਂ ਪੈਂਦੀਆਂ ਨੇ ਹਾਂਜੀ ਹੋਰ ਪੁੱਛੋ ਹਾਂ ਪੰਜਾ ਪੰਜਾਬ ਦੇ ਬਹੁਤ ਜ਼ਿਆਦਾ ਪ੍ਰਸਿੱਧ ਤਿਉਹਾਰ ਨੇਗੇ ਜਿਵੇ ਲੋਹੜੀ ਹੋ ਗਈ ਦਿਵਾਲੀ ਹੋ ਗਈ ਗੁਰਪੁਰਬ ਹੋ ਗਏ ਅਤੇ ਸ਼ਿਵਰਾਤਰੀ ਹੋ ਗਈ ਅਤੇ ਜਨਮ ਅਸ਼ਟਮੀ ਹੋ ਗਈ ਇਸ ਨੂੰ ਬਹੁਤ ਜ਼ਿਆਦਾ ਆਪਣਾ ਕੀ ਹੈ ਬਹੁਤ ਵਧੀਆ ਢੰਗ ਨਾਲ ਬਹੁਤ ਵਧੀਆ ਉਤਸ਼ਾਹ ਨਾਲ ਲੋਕ ਮਨਾਉਂਦੇ ਨੇ ਅਤੇ ਦਿਵਾਲੀ ਨੂੰ ਅਤੇ ਲੋਹੜੀ ਨੂੰ ਲੋਕ ਦਿਵਾਲੀ ਨੂੰ ਅਪ ਹਾਂਜੀ ਹਾਂ ਲੋਕ ਪ੍ਰਿਯ ਖਾਣਾ ਹੈਗਾ ਗਾ ਸਰੋਂ ਦਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਨਾਲ ਲੱਸੀ ਇਹ ਸਭ ਤੋਂ ਪ੍ਰਸਿੱਧ ਪ੍ਰ ਪ੍ਰਸਿੱਧ ਖਾਣਾ ਆਪਣੇ ਪੰਜਾਬ ਦਾ ਆ ਵ ਪੰਜਾਬ ਦੇ ਵਿੱਚ ਸਭ ਤੋਂ ਚੱਲਣ ਵਾਲੀ ਸੋਫਟ ਡਰਿੰਕ ਨਿੰਬੂ ਪਾਣੀ ਓਕੇ ਜੀ ਧੰਨਵਾਦ ਵੈਲਕਮ